ਜੀ ਹਾਂ ਆਪਾਂ ਆਪਦੇ ਰਸੋਈ ਵਿੱਚ ਵੱਖ ਵੱਖ ਬਰਤਨਾਂ ਦਾ ਯੂਜ਼ ਕਰ ਸਕਦੇ ਹਾਂ ਹਰੇਕ ਬਰਤਨ ਆਪਦੇ ਕੰਮ ਆਉਂਦਾ ਅਤੇ ਆਪਾਂ ਨੂੰ ਜਿਹੜੇ ਕੰਮ ਲਈ ਜਿਹੜਾ ਬਰਤਨ ਚਾਹੀਦਾ ਆਪਾਂ ਉਹਨੂੰ ਵਰਤ ਸਕਦੇ ਹਾਂ ਅਤੇ ਜਿਵੇਂ ਆਪਣਾ ਫੋਰ ਇਗਜ਼ਾਮਪਲ ਕੂਕਰ ਹੀ ਲੈ ਲਉ ਕੂਕਰ ਹੈ ਕੂਕਰ ਨੂੰ ਆਪਾਂ ਵੱਖ ਵੱਖ ਦਾਲਾਂ ਬਣਾ ਸਕਦੇ ਹੈ ਕੂਕਰ ਵਿੱਚ ਅਤੇ ਇਸ ਤੋਂ ਇਲਾਵਾ ਆਪਾਂ ਕੂਕਰ ਵਿੱਚ ਚਾਵਲ ਵੀ ਬਣਾ ਸਕਦੇ ਹੈ ਜਦੋਂ ਆਪਾਂ ਨੂੰ ਬਾਹਲੀ ਕਾਹਲ ਹੁੰਦੀ ਹੈ ਦੋ ਚਾਰ ਸੀਟੀਆਂ 'ਚ ਆਪਾਂ ਉਹਨੂੰ ਬਣਵਾ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੇ ਚਨੇ ਹੁੰਦੇ ਹੈ ਜਿਹਨੂੰ ਛੋਲੇ ਵੀ ਕਹਿ ਦਿੰਦੇ ਹੈ ਉਹ ਵੀ ਬਣਾ ਸਕਦੇ ਹੈ ਆਪਾਂ ਉਹਦੇ ਵਿੱਚ ਹਰ ਤਰ੍ਹਾਂ ਦੀ ਤਰੀ ਵਾਲੀ ਸਬਜ਼ੀ ਜਿਹੜੀ ਆਪਾਂ ਕੂਕਰ 'ਚ ਹੀ ਬਣਾਉਂਦੇ ਹਾਂ ਅਤੇ ਇਸ ਤੋਂ ਇਲਾਵਾ ਜਿਹੜੀ ਕੜਾਹੀ ਹੈ ਕੜਾਹੀ ਨੂੰ ਵੀ ਆਪਾਂ ਖੁੱਲ੍ਹੀ ਚੀਜ਼ ਬਣਾਉਣ ਲਈ ਯੂਜ਼ ਕਰਦੇ ਹੈ ਕਈ ਵਾਰੀ ਆਪਾਂ ਨੂੰ ਹੁੰਦਾ ਜਿਵੇਂ ਆਪਾਂ ਦਾਲ ਖੁੱਲ੍ਹੀ ਬਣਾਈ ਹੈ ਆਪਾਂ ਦਾਲ ਵੀ ਉਸ 'ਚ ਬਣਾ ਸਕਦੇ ਹੈ ਮੇਨਲੀ ਕੜਾਹੀ ਵਿੱਚ ਆਪਾਂ ਸੁੱਕੀਆਂ ਸਬਜ਼ੀਆਂ ਬਣਾਉਂਦੇ ਹਾਂ ਅਤੇ ਜੇ ਆਪਾਂ ਕੋਈ ਪ੍ਰਸ਼ਾਦ ਬਣਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਭਾਵੇਂ ਸੂਜੀ ਦਾ ਭਾਵੇਂ ਆਟੇ ਦਾ ਉਹ ਆਪਾਂ ਕੜਾਹੀ ਵਿੱਚ ਹੀ ਬਣਾਉਂਦੇ ਹਾਂ ਇਸ ਤੋਂ ਇਲਾਵਾ ਆਪਾਂ ਕੜਾਹੀ ਵਿੱਚ ਪਕੌੜੇ ਵੀ ਤਲ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਆਪਣੇ ਡੌਗੇ ਹੁੰਦੇ ਹੈ ਜਿਹੜੇ ਡੌਗਿਆਂ ਵਿੱਚ ਆਪਾਂ ਕੋਈ ਵੀ ਆਪਣੀ ਜਿਹੜੀ ਬਚੀ ਹੋਈ ਸਬਜ਼ੀ ਹੁੰਦੀ ਹੈ ਜਾਂ ਬਚਿਆਂ ਹੋਇਆ ਕੋਈ ਵੀ ਆਟਾ ਹੁੰਦਾ ਉਸ ਚੀਜ਼ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਜੇ ਆਪਾਂ ਕੋਈ ਵੀ ਜਿਵੇਂ ਆਪਾਂ ਪਕੌੜੇ ਹੀ ਬਣਾਉਂਦੇ ਹਾਂ ਤਾਂ ਕਿਸੇ ਵੀ ਚੀਜ਼ ਦਾ ਘੋਲ ਆ ਕੋਈ ਵੀ ਮਿਸ਼ਰਣ ਵਗੈਰਾ ਤਿਆਰ ਕਰਨਾ ਆਪਾਂ ਡੌਗਿਆਂ ਵਿੱਚ ਹੀ ਤਿਆਰ ਕਰਦੇ ਹਾਂ ਜਿਵੇਂ ਪਕੌੜਿਆਂ ਦਾ ਮਿਸ਼ਰਣ ਤਿਆਰ ਕਰਨ ਲਈ ਆਪਾਂ ਵੇਸਣ ਨੂੰ ਘੋਲ ਲੈਂਦੇ ਹਾਂ ਵਿੱਚ ਗੰਡੇ ਟਮਾਟਰ ਜੋ ਵੀ ਆਪਾਂ ਪਾਉਣਾ ਉਹਨੂੰ ਪਾ ਲੈਂਦੇ ਹਾਂ ਅਤੇ ਇਸ ਤੋਂ ਇਲਾਵਾ ਜਿਹੜੇ ਕੌਲੀ ਚਮਚੇ ਪਲੇਟ ਇਹਦੇ ਵਿੱਚ ਆਪਾਂ ਆਪਦਾ ਰੋਟੀ ਵਗੈਰਾ ਪਾ ਕੇ ਆਪਾਂ ਖਾਂਦੇ ਹਾਂ ਗਲਾਸ ਨੂੰ ਆਪਾਂ ਪਾਣੀ ਪੀਣ ਦੇ ਲਈ ਯੂਜ਼ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੇ ਕੜਛੀਆਂ ਇਹ ਮੇਨ ਆਪਣੀਆਂ ਜਿਹੜੀਆਂ ਵੀ ਸਬਜ਼ੀ ਵਗੈਰਾ ਪਾਉਣ ਦੇ ਕੰਮ ਆਉਂਦੀਆਂ ਅਤੇ ਜਿਹੜੇ ਡੱਬੇ ਵਗੈਰਾ ਹੁੰਦੇ ਹੈ ਕਿਚਨ 'ਚ ਪਏ ਉਹਨਾਂ ਨੂੰ ਆਪਾਂ ਆਪ ਆਪਣੇ ਜਿਹੜੇ ਮਸਾਲੇ ਹੁੰਦੇ ਹੈ ਉਹ ਸਾਰੇ ਚੀਜ਼ਾਂ ਇਸ ਪਾ ਕੇ ਰੱਖਦੇ ਹਾਂ ਆਪਾਂ ਇਹਦੇ ਵਿੱਚ